ਹੈਲੋ ਨਸਮਕਾਰ ਜੀ ਹਾਂਜੀ ਰੇਡੀਮੇਡ 'ਚ ਜ਼ਿਆਦਾ ਬੈਸਟ ਹੈਗਾ ਜੀ ਰੇਡੀਮੇਡ 'ਚ ਤੁਹਾਨੂੰ ਰੇਡੀਮੇਡ 'ਚ ਤੁਹਾਨੂੰ ਵਰਾਇਟੀ ਇੱਕ ਤਾਂ ਵਧੀਆ ਮਿਲੇਗੀ ਡਿਜ਼ਾਇਨ ਵਧੀਆ ਮਿਲ ਜਾਣਗੇ ਹਾਂਜੀ ਇੱਕ ਤਾਂ ਸਸਤਾ ਮਿਲੇਗਾ

ਖੁਦ ਬਣਵਾਉਣ 'ਚ ਮਹਿੰਗਾ ਪੈਂਦਾ ਹੈ ਹਾਂਜੀ ਹਾਂਜੀ ਉਹਦੇ 'ਚ ਲਾ ਕੇ ਤੁਹਾਨੂੰ ਇੱਕਤਾਂ ਤੁਹਾਨੂੰ ਪਰੇਸ਼ਾਨੀ ਹੋਏਗੀ ਘਰ ਕੰਮ ਕਰਵਾਉਣ 'ਚ ਹਾਂਜੀ ਹਾਂਜੀ ਹਾਂਜੀ ਉਹ ਘਰ ਆ ਕੇ ਹੋਏਗਾ ਅਤੇ ਉਹਦੀ ਜ਼ਿਆਦਾ ਪਰੇਸ਼ਾਨੀ ਆਏਗੀ ਤੁਹਾਨੂੰ ਅਤੇ ਤੁਹਾਨੂੰ ਬਣਾ ਕੇ ਦੇਵਾਂਗੇ ਰੇਡੀਮੇਡ ਹਾਂਜੀ ਸੋਫੇ ਵਗੈਰਾ ਡਾਇਨਿੰਗ ਉਹ ਵਿਦ ਕਰ ਕਰਾਂਗੇ ਜੀ ਹਾਂਜੀ ਉਹਦਾ ਵਿੱਚ ਕਰ ਦਾਂਗੇ ਸੋਫੇ ਦਾ ਪ੍ਰਾਈਜ਼ ਜੀ ਪੰਦਰਾਂ ਹਜ਼ਾਰ ਤੋਂ ਸ਼ੁਰੂ ਹੈ ਫਿਰ ਕਿੰਨੀਆਂ ਸੀਟਾਂ ਲੈਣੀਆਂ ਫਾਈਵ ਸ਼ੀਟਰ ਸੈਵਨ ਸ਼ੀਟਰ ਵੀਹ ਸ਼ੀਟਰ ਕਿੰਨੀਆਂ ਸੀਟਾਂ ਉਸ ਹਿਸਾਬ ਨਾਲ ਰੇਟ ਹੋਏਗਾ ਕੋਰਨਰ ਲੈਣਾ ਉਹਦਾ ਅਲੱਗ ਰੇਟ ਹੋਏਗਾ ਨੋਰਮਲ ਪੰਦਰਾਂ ਵੀਹ ਹਜ਼ਾਰ ਦੀ ਰੇਂਜ਼ ਦੇ ਵਿੱਚ ਮਿਲ ਜਾਏਗਾ ਜੀ ਹਾਂਜੀ ਬੈੱਡ ਰੇਡੀਮੇਡ ਬਾਰਾਂ ਤੇਰਾਂ ਹਜ਼ਾਰ ਤੋਂ ਸ਼ੁਰੂ ਹੋ ਜਾਏਗਾ ਜੀ ਉਸ ਤੋਂ ਅੱਗੇ ਜਿੰਨਾ ਮਰਜ਼ੀ ਉੱਪਰ ਕਰੀ ਜਾਓਗੇ ਤੁਸੀਂ ਹਾਂਜੀ ਹਾਂਜੀ

ਸਾਡੀ ਦੁਕਾਨ 'ਤੇ ਆ ਕੇ ਤੁਸੀਂ ਜਿੰਨਾ ਮਰਜ਼ੀ ਓ ਕਰ ਸਕਦੇ ਹੋ ਆਡਰ ਪਾ ਸਕਦੇ ਹਾਂ ਹਾਂ ਤੁਹਾਨੂੰ ਕਰ ਦਿਆਂਗੇ ਹਾਂਜੀ ਠੀਕ ਹੈ ਹਾਂਜੀ ਹਾਂਜੀ ਹਾਂਜੀ ਜੀ ਠੀਕ ਹੈ ਜੀ ਹਾਂਜੀ ਓਕੇ ਜੀ